ਸਤਿ ਸ਼੍ਰੀ ਅਕਾਲ ਸਰ ਮੈਂ ਕਾਰਤਿਕ ਬੋਲ ਰਿਹਾ ਪਠਾਨਕੋਟ ਤੋਂ ਸਰ ਮੈਂ ਪਠਾਨਕੋਟ ਦੀ ਗੱਲ ਕਰ ਰਿਹਾ ਸਰ ਪਠਾਨਕੋਟ ਵਿੱਚ ਕਾਫ਼ੀ ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ ਟਰੈਵਲਿੰਗ ਸਹੂਲਤਾਂ ਸਭ ਤੋਂ ਵੱਧ ਪਠਾਨਕੋਟ ਵਿੱਚ ਹੀ ਹੈ ਜਿਸ ਤੱਕ ਮੈਨੂੰ ਲੱਗਦਾ ਹੈ ਕਿ ਆਪਾਂ ਪਠਾਨਕੋਟ ਵਿੱਚ ਕਿਤੇ ਵੀ ਜਾਣਾ ਹੋਵੇ ਤਾਂ ਸਾਡੇ ਲਈ ਸਾਰੇ ਇੱਕ ਵਾਹਨ ਉਪਲੱਬਧ ਕਰਵਾਇਆ ਗਿਆ ਹੈ ਸਰਕਾਰ ਵੱਲੋਂ ਜੋ ਕਿ ਅਸੀਂ ਇਕ ਇੱਕ ਵਾਰ ਕਟਰਾ ਗਏ ਸੀ ਅਤੇ ਅਸੀਂ ਟ੍ਰੇਨ ਵਿੱਚ ਗਏ ਸੀ ਸਾਨੂੰ ਕਾਫ਼ੀ ਨਜ਼ਦੀਕੀ ਤੋਂ ਟ੍ਰੇਨ ਮਿਲ ਲਈ ਗਈ ਸੀ ਪਠਾਨਕੋਟ ਤੋਂ ਔਰ ਟ੍ਰੇਨ ਦੀ ਟਿਕਟ ਵੀ ਬਹੁਤ ਸਸਤੀ ਸੀ ਅਤੇ ਅਸੀਂ ਕਿਤੇ ਦੋ ਦੋ ਸੌ ਤਿੰਨ ਸੌ ਮੀਟਰ ਕਿਲੋਮੀਟਰ ਕਿਲੋਮੀਟਰ 'ਤੇ ਜਾਣਾ ਹੈ ਤਾਂ ਅਸੀਂ ਬਸ ਵਿਚ ਟਰੈਵਲ ਕਰ ਲੈਂਦੇ ਹਾਂ ਅਤੇ ਅਗਰ ਅਸੀਂ ਕੁਛ ਹੋਰ ਨੇੜੇ ਜਾਣਾ ਹੋਵੇ ਤਾਂ ਅਸੀਂ ਆਟੋ ਰਿਕਸ਼ਾ ਤੋਂ ਚੱਲ ਜਾਂਦੇ ਹਾਂ ਔਰ ਸਾਡੇ ਪਠਾਨਕੋਟ ਵਿੱਚ ਅਸੀਂ ਆਪਣੇ ਵੀ ਵਾਹਨ ਰੱਖੇ ਹੋਏ ਹਨ ਜਿਵੇਂ ਬਾਈਕ ਸਾਈਕਲ ਹੋ ਗਈ ਔਰ ਸਾਨੂੰ ਐਮਰਜੈਂਸੀ ਬਾਈਕ 'ਤੇ ਵੀ ਚਲ ਜਾਂਦੇ ਹਾਂ ਜੋ ਕਿ ਸਾਡੇ ਲਈ ਕਾਫ਼ੀ ਫ਼ਾਇਦੇਮੰਦ ਹੈ ਔਰ ਇਸ ਇਹ ਸੁਆ ਸਹੂਲਤਾਂ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਕਿ ਸਾਡੇ ਸਾਡੇ ਲਈ ਕਾਫ਼ੀ ਕਾਫ਼ੀ ਫ਼ਾਇਦੇਮੰਦ ਹਨ ਪਠਾਨਕੋਟ ਵਿੱਚ ਇਹ ਸਹੂਲਤ ਕਾਫ਼ੀ ਜ਼ਿਆਦਾ ਹੈ ਕਿਸੀ ਵੀ ਵਿਅਕਤੀ ਨੂੰ ਇਸ ਦੀ ਤੰਗੀ ਨਹੀਂ ਹੋ ਸਕਦੀ ਕਿਉਂਕਿ ਇੱਥੇ ਲੋਕਲ ਬੱਸਾਂ ਔਰ ਲੋਕਲ ਟ੍ਰੇਨਾਂ ਕਾਫ਼ੀ ਚੱਲਦੀਆਂ ਹਨ ਜੋ ਕੋਈ ਵੀ ਵਿਅਕਤੀ ਜਦੋਂ ਮਰਜੀ ਜਿੱਥੇ ਮਰਜੀ ਆ ਜਾ ਸਕਦਾ ਹੈ ਐਮਰਜੰਸੀ ਔਰ ਇਹ ਕਦੇ ਵੀ ਬੰਦ ਨਹੀਂ ਹੋਣੀ ਚਾਹੀਦੀਆ ਔਰ ਹੋਰ ਵੀ ਇਹਨਾਂ ਦਾ ਵਾਧਾ ਕਰਵਾਉਣਾ ਚਾਹੀਦਾ ਹੈ ਵਧੀਆ ਤਰੀਕੇ ਨਾਲ ਹੋਣੀ ਚਾਹੀਦੀਆ ਹਨ ਜਿਸ ਨਾਲ ਸਾਨੂੰ ਵੀ ਕਾਫ਼ੀ ਫ਼ਾਇਦਾ ਹੋਵੇ ਔਰ ਸਰਕਾਰ ਨੂੰ ਵੀ ਫ਼ਾਇਦਾ ਹੋਣੇ ਚਾਹੀਦਾ ਹੈ ਕਿਉਂਕਿ ਸਰਕਾਰ ਸਾਡੇ ਲਈ ਕਾਫ਼ੀ ਕੁਛ ਕਰਦੀ ਹੈ ਇਸ ਲਈ ਇਸ ਇਸ ਲਈ ਸਾਨੂੰ ਸਹੂਲਤਾਂ ਆਮ ਤੌਰ 'ਤੇ ਵਰਤੋਂ ਕਰਦੇ ਟਰਾਂਸਫੋਰਮ ਟਰਾਂਸ ਟਰਾਂਸਪੋਰਟ ਬਾਈ ਗੱਡੀਆਂ ਕਾਫ਼ੀ ਫ਼ਾਇਦੇਮੰਦ ਹੁੰਦੀਆਂ ਹਨ ਧੰਨਵਾਦ